ਮੈਂ ਜਿੱਥੇ ਰਹਿੰਦੀ ਹਾਂ ਉਸ ਨੇੜੇ ਤਾਂ ਕੋਈ ਵੀ ਜੰਗਲ ਨਹੀਂ ਹੈ ਸਾਡੇ ਪਿੰਡ ਤੋਂ ਬਹੁਤ ਦੂਰ ਹੈਗੇ ਹਨ ਉੱਥੇ ਜਾਣਾ ਬਾ ਬਾਲੀ ਸਾਨੂੰ ਬਾਰੀ ਸਾਨੂੰ ਕਾਰ ਜਾਂ ਰੇਲ ਗੱਡੀ ਦੀ ਲੋੜ ਪੈਂਦੀ ਹੈ ਉੱਥੇ ਬਹੁਤ ਹੀ ਜੰਗਲ ਹਨ ਜਿੱਥੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਵੀ ਹਨ ਜਿਵੇਂ ਸ਼ੇਰ ਚੀਤਾ ਬਾਂਦਰ ਤੇ ਹੋਰ ਵੀ ਜਾਨਵਰ ਹਨ ਉਹ ਉਹ ਉਸ ਪਾਸੇ ਹਨ ਜਿੰਨਾ ਉੱਥੇ ਉਸ ਪਾਸੇ ਹਨ ਜਿੰਨਾਂ ਨੂੰ ਲੋਕ ਵੇਖਣ ਜਾਂਦੇ ਹਨ ਘੁੰਮ ਕੇ ਆਉਂਦੇ ਹਨ ਅੱਜ ਕੱਲ ਜਾਨਵਰ ਖਤਮ ਹੋ ਗਏ ਹਨ ਜੋ ਬਚੇ ਹਨ ਉਹਨਾਂ ਨੂੰ ਕੈਦ ਵਿੱਚ ਰੱਖਿਆ ਜਾਂਦਾ ਹੈ ਜਾਂਦਾ ਹੈ ਇਸੇ ਸੀਫਰ ਲੋਕਾਂ ਨੂੰ ਇਹਨਾਂ ਦਿਖਾਉਣ ਲਈ ਹੀ ਉੱਥੇ ਰੱਖੇ ਜਾਂਦੇ ਹਨ ਕਿ ਬਹੁਤ ਹੀ ਵਧੀਆ ਜਗ੍ਹਾ ਹੈ ਤਾਂ ਹਾਂ ਤੇ ਤਰ੍ਹਾਂ ਤਰ੍ਹਾਂ ਦੇ ਰੁੱਖ ਵੀ ਵੇਖਣ ਨੂੰ ਮਿਲਦੇ ਹਨ ਜੋ ਅਸੀਂ ਕਦੇ ਵੇਖੇ ਵੀ ਨਹੀਂ ਹੁੰਦੇ ਹਨ ਉੱਥੋਂ ਨਜ਼ਾਰਾ ਬਹੁਤ ਹੀ ਸੋਹਣਾ ਹੁੰਦਾ ਹੈ